ਹੈਲੋ ਹਾਂਜੀ ਕੀ ਹਾਲ ਹੈ ਜੀ ਸੜਕਾਂ ਤਾਂ ਇੱਧਰ ਸਾਡੇ ਆਲੇ ਪਾਸੇ ਤਾਂ ਇਹ ਤੋਂ ਵੀ ਬੁਰਾ ਹਾਲ ਹੈ ਜੀ ਇਹ ਸੜਕਾਂ ਇੰਨੀਆਂ ਕੁ ਟੁੱਟੀਆਂ ਪਈਆਂ ਨੇ ਨਾਲੀਆਂ ਦਾ ਪਾਣੀ ਸੀਵਰੇਜ ਦਾ ਪਾਣੀ ਸਾਡੀਆਂ ਗਲੀਆਂ ਪਵੇ ਹਾਂ ਸਭ ਸਾਡੇ ਤਾਂ ਸਾ ਹਾਂਜੀ ਹਾਂਜੀ ਓਹ ਮੈਂ ਅਜੇ ਕੱਲ੍ਹ ਬਾਜ਼ਾਰ ਹੋ ਆਇਆ ਘੰਟਾ ਘਰ ਉੱਥੇ ਉਹ 'ਚ ਚੌਂਕ ਦੇ ਉੱਤੇ ਇੰਨਾਂ ਟਰੈਫਿਕ ਹੋਇਆ ਕਿ ਦੋ ਘੰਟੇ ਮੈਂ ਤਾਂ ਟਰੈਫਿਕ ਦੇ ਵਿੱਚ ਫਸਿਆ ਰਿਹਾ ਨਾ ਉੱਥੇ ਕੋਈ ਥਮਾ ਲੈਣ ਵਾਲਾ ਸੀ ਟਰੈਫਿਕ ਨੂੰ ਉੱਧਰੋਂ ਖੱਡੇ ਸੜਕਾਂ 'ਤੇ ਟੁੱਟੀਆਂ ਸੜਕਾਂ ਨੇ ਇਹ ਜਿਹੜੇ ਘੰਟਾ ਘਰ ਨਿਕਲਣ ਦਾ ਰਾਹ ਹੀ ਕੋਈ ਨਹੀਂ ਹੈਗਾ ਕਿਧਰੇ ਪਤਾ ਨਹੀਂ ਓਧਰੋਂ ਸੀਵਰੇਜ ਖੁੱਲ੍ਹੇ ਨੇ ਸਾਰੇ ਸੀਵਰੇਜ ਦੇ ਨਾਲ ਸੜਕਾਂ ਭਰੀਆਂ ਹੋਈਆਂ ਨੇ ਗੰਦ ਵੱਜਿਆ ਪਿਆ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਹਾਂ ਓ ਮੈਂ ਤਾਂ ਇੱਧਰ ਮਕਾਨ ਕਿੱਧਰੇ ਹੋਰ ਚੇਂਜ ਕਰਕੇ ਵੇਖਣ ਲੱਗਿਆਂ ਮੈਖਾਂ ਕਿਤੇ ਹੋਰ ਜਾਂਦੇ ਕੋਈ ਵਧੀਆ ਸਾਫ ਜਿਹਾ ਏਰੀਆ ਨਵੀਆਂ ਇੱਧਰ ਨਵੀਂ ਬਲੋਰ ਚੌਂਕ ਵੱਲ ਵੈਸੇ ਨਵੀਂ ਕਲੋਨੀ ਉਹ ਸੜਕਾਂ ਥੋੜ੍ਹੀਆਂ ਫਿਰ ਵੀ ਠੀਕ ਹੈਗੀਆਂ ਨੇ ਬਾਕੀ ਇੱਧਰ ਸ਼ਹਿਰ ਦੇ ਅੰਦਰ ਤਾਂ ਗੰਦ ਵੱਜਿਆ ਪਿਆ ਪੂਰਾ ਓਹ ਟੁੱਟੀਆਂ ਸੜਕਾਂ ਖੱਡੇ ਬੜੇ ਨੇ ਖੱਡਿਆਂ 'ਚ ਪਾਣੀ ਰੁਕਦਾ ਉਹਦੇ ਨਾਲ ਹੋਰ ਜਿਹੜਾ ਹੈਗਾ ਜਿਹੜੀ ਮਾੜੀ ਮੋਟੀ ਸੜਕ ਬਣੀ ਆ ਉਹ ਵੀ ਪੱਟਣੀ ਸ਼ੁਰੂ ਹੋ ਜਾਂਦੀ ਹੈਗੀ ਉਹ ਖੱਡੇ ਹੋਰ ਵੱਡੇ ਹੋ ਜਾਂਦੇ ਨੇ ਉਹ ਖੱਡਿਆਂ ਦੀ ਵਜ੍ਹਾ ਦੇ ਨਾਲ ਤਾਂ ਉੱਥੇ ਟਰੈਫਿਕ ਹੁੰਦਾ ਨਾ ਲੰਘਿਆ ਜਾਂਦਾ ਨਾ ਟੱਪਿਆ ਜਾਂਦਾ ਇੱਕ ਵਾਰੀ ਕੋਈ ਵੱਡਾ ਵੀਹਕਲ ਅੱਗੇ ਆ ਕੇ ਖੜ੍ਹ ਜਾਵੇ ਅਸੀਂ ਉਹ ਸਾਰਾ ਅਗਲੇ ਪਿਛਲੇ ਵਾਲੇ ਨੂੰ ਨਾਲ ਰੋਕ ਕੇ ਬਹਿ ਜਾਂਦੇ ਨੇ ਮਕਾਨ ਹੋਰ ਪਾਸੇ ਲੈ ਲਓ ਤੁਸੀਂ ਵੀ ਵਧੀਆ ਰਹੇਗਾ ਸੜਕਾਂ ਸੁੜਕਾਂ ਉੱਧਰ ਵਧੀਆ ਬਣੀਆਂ ਹੋਈਆਂ ਹਾਂ ਠੀਕ ਹੈ ਜੀ